ਮੈਨੂੰ ਪੇਂਟਿੰਗ ਕਰਨੀ ਬਹੁਤ ਹੀ ਜ਼ਿਆਦਾ ਵਧੀਆ ਲੱਗਦੀ ਹੈ ਅਤੇ ਮੈਂ ਅਕਸਰ ਹੀ ਪੇਂਟਿੰਗਜ਼ ਕਰਦੀ ਰਹਿੰਦੀ ਹਾਂ ਮੇਰੇ ਕਈ ਦੋਸਤ ਵੀ ਮੈਨੂੰ ਕਹਿੰਦੇ ਹਨ ਕਿ ਮੈਂ ਉਹਨਾਂ ਦੇ ਲਈ ਕੁਝ ਬਣਾ ਕੇ ਲੈ ਕੇ ਆਵਾਂ ਅਤੇ ਮੈਂ ਆ ਪਹਿਲਾਂ ਕਾਰਡ ਆਪਣੇ ਟੀਚਰਸ ਦੇ ਲਈ ਟੀਚਰਸ ਡੇ 'ਤੇ ਬਣਾਇਆ ਸੀ ਜਿਹੜਾ ਕਿ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਵਧੀਆ ਲੱਗਿਆ ਸੀ ਮੈਂ ਅਕਸਰ ਹੀ ਉਹਨਾਂ ਨੂੰ ਟੀਚਰਸ ਡੇ 'ਤੇ ਬਿਊਟੀਫੁਲ ਕਾਟ ਬਣਾ ਕੇ ਗਿਫਟ ਕਰਦੀ ਹਾਂ ਅਤੇ ਮੈਂ ਆਪਣੀ ਇੱਕ ਬੈਸਟ ਫਰੈਂਡ ਨੂੰ ਉਹਦੇ ਬਰਡੇ 'ਤੇ ਇੱਕ ਦਿਲ ਦਾ ਤੋਹਫ਼ਾ ਬਣਾ ਕੇ ਉਸ ਨੂੰ ਕਾਫ਼ੀ ਬਿਊਟੀਫੁਲ ਤਰੀਕੇ ਦੇ ਨਾਲ ਬਣਾਇਆ ਸੀ ਜਿਹੜਾ ਕਿ ਉਸਨੂੰ ਬਹੁਤ ਜ਼ਿਆਦਾ ਵਧੀਆ ਲੱਗਿਆ ਸੀ ਅਤੇ ਮੈਂ ਆਪਣੇ ਦੋਸਤਾਂ ਦੇ ਲਈ ਅਕਸਰ ਹੀ ਕੁਛ ਨਾ ਕੁਛ ਬਣਾਉਂਦੀ ਰਹਿੰਦੀ ਹਾਂ ਅਤੇ ਇੱਕ ਮੇਰੀ ਬੈਸਟ ਫਰੈਂਡ ਹੈ ਉਸ ਦੇ ਲਈ ਮੈਂ ਇੱਕ ਇੱਕ ਗੁੱਡੀ ਗੁੱਡੀ ਦੀ ਡਰਾਇੰਗ ਬਣਾ ਕੇ ਉਸਨੂੰ ਦਿੱਤੀ ਸੀ ਜਿਹੜੀ ਕਿ ਉਹ ਆਪਣੀ ਦੀਵਾਰ 'ਤੇ ਹਜੇ ਤੱਕ ਵੀ ਉਹਨਾਂ ਦੇ ਘਰ ਲੱਗੀ ਹੋਈ ਹੈ ਉਸਨੂੰ ਮੇਰੀ ਉਹ ਪੇਂਟਿੰਗ ਬਹੁਤ ਜ਼ਿਆਦਾ ਵਧੀਆ ਲੱਗੀ ਸੀ ਅਤੇ ਉਹ ਹੀ ਉਹ ਹੀ ਪੇਂਟਿੰਗ ਨੂੰ ਜ਼ਿਆਦਾ ਪਸੰਦ ਕੀਤਾ ਸੀਗਾ ਉਹ ਮੇਰੇ ਸਾਰੇ ਦੋਸਤ ਹੀ ਮੇਰੇ ਤੋਂ ਕੁਛ ਨਾ ਕੁਛ ਬਣਵਾਉਂਦੇ ਰਹਿੰਦੇ ਹਨ ਕਿਉਂਕਿ ਇਹ ਉਹ ਜਾਣਦੇ ਹਨ ਕਿ ਮੈਂ ਇੱਕ ਵਧੀਆ ਪੇਂਟਰ ਹਾਂ ਅਤੇ ਮੈਨੂੰ ਪੇਂਟਿੰਗਸ ਦੇ ਦਾ ਕਾਫ਼ੀ ਸ਼ੌਂਕ ਹੈ ਅਤੇ ਮੈਂ ਅਪ ਸਾਰੀਆਂ ਪੇਂਟਿੰਗ ਨੂੰ ਆਪਣੇ ਦਿਲ ਦੇ ਨਾਲ ਹੀ ਦਿਲ ਅਤੇ ਆਪਣੀਆਂ ਪਰਸਨਲ ਫੀਲਿੰਗਸ ਅਤੇ ਫੀਲ ਫੀਲਿੰਗਸ ਦੇ ਨਾਲ ਹੀ ਬਣਾਉਂਦੀ ਹਾਂ ਜਿਸ ਕਰਕੇ ਉਹ ਕਾਫ਼ੀ ਪ੍ਰਭਾਵਿਤ ਲੱਗਦੀਆਂ ਹਨ ਅਤੇ ਇਸ ਜਿਸ ਕਰਕੇ ਮੈਂ ਬਹੁਤ ਹੀ ਜ਼ਿਆਦਾ ਵਧੀਆ ਫੀਲ ਕਰਦੀ ਹਾਂ ਮੈਨੂੰ ਅਕਸਰ ਹੀ ਦੂਜਿਆਂ ਨੂੰ ਖੁਸ਼ ਵੇਖਣਾ ਬਹੁਤ ਹੀ ਜ਼ਿਆਦਾ ਵਧੀਆ ਲੱਗਦਾ ਹੈ ਅਤੇ ਇਸ ਕਰਕੇ ਹੀ ਮੈਂ ਆਪਣੇ ਦੋਸਤਾਂ ਨੂੰ ਜਾਂ ਟੀਚਰਸ ਨੂੰ ਕੁਝ ਨਾ ਕੁਝ ਬਣਾ ਕੇ ਜਾਂ ਗਿਫਟ ਕਰਦੀ ਰਹਿੰਦੀ ਹਾਂ ਕਾਰਡ ਕੂਡ ਵਗੈਰਾ ਬ ਬਣਾ ਕੇ ਉਹਨਾਂ ਨੂੰ ਮੈਂ ਗਿਫਟ ਕਰਦੀ ਰਹਿੰਦੀ ਹਾਂ ਅਤੇ ਇਹ ਸਭ ਕਰਨਾ ਮੈਨੂੰ ਕੋਈ ਵੀ ਇੱਕ ਬੋਝ ਨਹੀਂ ਲੱਗਦਾ ਕਿਉਂਕਿ ਪੇਂਟਿੰਗ ਮੇਰਾ ਪ੍ਰੋਫੈਸ਼ਨ ਹੈ ਅਤੇ ਮੈਂ ਸਾਰੀ ਉਮਰ ਭਰ ਪੇਟਿੰਗ ਕਰਦੀ ਰਹਿਣਾ ਚਾਹੁੰਦੀ ਹਾਂ ਅਤੇ ਇਹ ਮੇਰਾ ਪਰਸਨਲ ਐਕਸਪੀਰੀਅੰਸ ਹੈ ਅਤੇ ਮੈਂ ਜਿਹੜਾ ਕਿ ਸਾਰਿਆਂ ਨੂੰ ਫੀ ਸਾਰਿਆਂ ਨੂੰ ਦਿਖਾਉਣਾ ਚਾਹੁੰਦੀ ਹਾਂ ਕਿ ਮੈਂ ਪੇਟਿੰਗਸ ਬਹੁਤ ਜ਼ਿਆਦਾ ਸੋਹਣਾ ਕਰਦੀ ਹਾਂ ਅਤੇ ਅੱਗੇ ਆਪਣੀ ਜ਼ਿੰਦਗੀ ਦੇ ਵਿੱਚ ਵੀ ਮੈਂ ਪੇਂਟਿੰਗਸ ਨੂੰ ਇਸ ਤਰ੍ਹਾਂ ਕਰਦੀ ਰਹਿਣਾ ਚਾਹੁੰਦੀ ਹਾਂ